ਮੈਂ ਆਪਣੀ ਦੌੜ ਦੀ ਤਿਆਰੀ ਵਿੱਚ ਜ਼ਿਆਦਾ ਪ੍ਰੋਟੀਨ ਲੈਣਾ ਪਸੰਦ ਕਰਦਾ ਹਾਂ ਜਿਵੇਂ ਕਿ ਆਂਡੇ ਚਿਕਨ ਜਾਂ ਹੋਰ ਕੋਈ ਹਰੀਆਂ ਸਬਜ਼ੀਆਂ ਲਾ ਲਉ ਅਤੇ ਅਤੇ ਮੈਂ ਦਿਨ ਵਿੱਚ ਘੱਟੋ ਘੱਟ ਵੀ ਤਿੰਨ ਜਾਂ ਚਾਰ ਲੀਟਰ ਪਾਣੀ ਪੀਂਦਾ ਹਾਂ ਜਿਸਦੇ ਨਾਲ ਕਿ ਮੇਰਾ ਸਰੀਰ ਤੰਦਰੁਸ਼ਤ ਅਤੇ ਸ਼ਾਮ ਦੀ ਸਿਖਲਾਈ ਲਈ ਤਿਆਰ ਰਹਿੰਦਾ ਹੈ